ਹੈਲੋ ਫਲਿੱਪਕਾਰਟ ਇੱਕ ਹਫਤਾ ਪਹਿਲਾਂ ਮੈਂ ਤੁਹਾਡੇ ਕੋਲ਼ੋ ਨਾਵਲ ਜਿਸ ਦਾ ਨਾਮ ਇਹੋ ਹਮਾਰਾ ਜੀਵਨਾ ਹੈ ਜੋ ਕਿ ਦਲੀਪ ਕੌਰ ਟਿਵਾਣਾ ਨੇ ਲਿਖਿਆ ਹੋਇਆ ਹੈ ਇਹ ਆਰਡਰ ਕੀਤਾ ਸੀ ਇਹ ਮੈਨੂੰ ਮਿਲ ਗਿਆ ਹੈ ਅਤੇ ਮੈਂ ਇਸ ਨੂੰ ਪਾ ਕੇ ਬਹੁਤ ਨਿਰਾਸ਼ ਹਾਂ ਕਿਉਂਕਿ ਜਦੋਂ ਮੈਂ ਇਸ ਨੂੰ ਖੋਲ੍ਹਿਆ ਇਸ ਦੀ ਪੇਪਰ ਕੁਆਲਟੀ ਕੰਟੈਂਟ ਅਤੇ ਕਵਰ ਬਹੁਤ ਹੀ ਖਸਤਾ ਹਾਲਤ ਵਿੱਚ ਸਨ ਅਤੇ ਫਟੇ ਹੋਏ ਸਨ ਜੋ ਕਿ ਪੜ੍ਹੇ ਜਿਸ ਵਿੱਚ ਪੜ੍ਹ ਪੜ੍ਹਿਆ ਵੀ ਨਹੀਂ ਜਾ ਸਕਦਾ ਧੰਨਵਾਦ